ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਭੰਗੜਾ ਪੰਜਾਬ ਦਾ ਲੋਕ ਨਾਚ ਹੈ ਮੈਂ ਵੀ ਆਪਣੇ ਸਕੂਲ ਟਾਈਮ ਤੋਂ ਲੈ ਕੇ ਹੁਣ ਤੱਕ ਭੰਗੜੇ ਵਿੱਚ ਹਿੱਸਾ ਲੈ ਰਿਹਾ ਹਾਂ ਅਤੇ ਮੈਂ ਹਮੇਸ਼ਾ ਭੰਗੜੇ ਵਿੱਚ ਫਸਟ ਪੋਜੀਸ਼ਨ ਹਾਸਲ ਕੀਤੀ ਹੈ ਜੇ ਕਰ ਮੇਰੇ ਕੋਈ ਦੋਸਤ ਭੰਗੜਾ ਐਰੋਬਿਕਸ ਵਿੱਚ ਹਿੱਸਾ ਲੈਂਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਭੰਗੜੇ ਬਾਰੇ ਦੱਸਾਂਗਾ ਕਿ ਭੰਗੜਾ ਸਾਡਾ ਲੋਕ ਨਾਚ ਹੈ ਅਤੇ ਇਸ ਵਿੱਚ ਪੰਜ ਮੇਨ ਸਟੈਪ ਹਨ ਜਿਵੇਂ ਕਿ ਤੇਜੀ ਤਾੜੀ ਝੂਮਰ ਪਟਾਕਾ ਡਬਲ ਝਾਫਾ ਖਿੱਚਾਂ ਫੁਲਕਾ ਆਦ ਅਤੇ ਫਿਰ ਮੈਂ ਉਸ ਨੂੰ ਭੰਗੜੇ ਦੇ ਪਹਿਰਾਵੇ ਬਾਰੇ ਦੱਸਾਂਗਾ ਕਿਉਂਕਿ ਭੰਗੜਾ ਪਾਉਂਦੇ ਸਮੇਂ ਅਸੀਂ ਫੋਕ ਡਰੈਸ ਹੀ ਪਾਉਣੀ ਹੁੰਦੀ ਹੈ ਇਹ ਸਾਡੇ ਭੰਗੜੇ ਨੂੰ ਹੋਰ ਰੋਮਾਂਚਕ ਬਣਾ ਦਿੰਦਾ ਹੈ ਪਰ ਭੰਗੜਾ ਸਿਖਾਉਂਦੇ ਸਮੇਂ ਮੈਨੂੰ ਕੁਝ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪਿਆ ਕਿਉਂਕਿ ਜਿਸ ਨੂੰ ਮੈਂ ਭੰਗੜਾ ਸਿਖਾਂਦਾ ਸੀ ਉਹ ਅਜੇ ਬਹੁਤ ਛੋਟਾ ਸੀ ਉਸ ਦੀ ਉਮਰ ਬਹੁਤ ਛੋਟੀ ਸੀ ਉਸ ਨੂੰ ਸਮਝਾਉਣ ਵਿੱਚ ਥੋੜੀਆਂ ਦਿੱਕਤਾਂ ਦਾ ਮੈਨੂੰ ਸਾਹਮਣਾ ਕਰਨਾ ਪੈਂਦਾ ਸੀ